ਪੰਜ ਫਰਵਰੀ ਦੋ ਹਜ਼ਾਰ ਪੰਜ ਸੱਤ ਨਵੰਬਰ ਦੋ ਹਜ਼ਾਰ ਨੌ ਛੇ ਅਗਸਤ ਦੋ ਹਜ਼ਾਰ ਦਸ ਤੀਹ ਅਕਤੂਬਰ ਦੋ ਹਜ਼ਾਰ ਪੰਦਰਾਂ ਸਤਾਈ ਨਵੰਬਰ ਦੋ ਹਜ਼ਾਰ ਸਤਾਰਾਂ